ਅਸੀਂ ਸਰ ਜ਼ਿਆਦਾ ਤੌਰ 'ਤੇ ਧਾਰਮਿਕ ਅਸਥਾਨ 'ਤੇ ਹੀ ਜਾਣਾ ਪਸੰਦ ਕਰਦੇ ਐਂ ਕਿਉਂਕਿ ਜਿੰਨਾਂ ਹੋ ਸਕੇ ਗੁਰੂ ਘਰ ਦੇ ਨਾਲ ਹੀ ਸਰ ਸੰਬੰਧ ਰੱਖਦੇ ਐਂ ਕੋਈ ਇੱਥੇ ਅਸੀਂ ਜਿੱਥੇ ਅਸਲ ਕੰਮ ਕਰਦੇ ਹਾਂ ਜੇ ਗੁਰਦੁਆਰਾ ਸ਼੍ਰੀ ਜੋਤੀ ਸੂ ਸਾਹਿਬ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਹਨ ਜਿਹਨਾਂ ਦੇ ਕਾਰਨ ਸਾਨੂੰ ਜ਼ਿਆਦਾ ਲਗਾਓ ਗੁਰੂ ਘਰ ਦੇ ਨਾਲ ਹੀ ਹੈ ਗੁਰੂ ਘਰ ਜਾਊਂਗੇ ਕੁਛ ਚੰਗੀ ਸ਼ਿਕਸ਼ਾ ਹੀ ਲ ਲੈ ਕੇ ਆਊਂਗੇ ਕਈ ਚ ਰਿਸ਼ਤੇਦਾਰ ਸਰ ਕਹਿੰਦੇ ਸਾਡੇ ਆਉਂਦੇ ਨਹੀਂ ਜਾਂ ਸਾਡੇ ਕੋਲ ਸਮਾਂ ਹੀ ਨਹੀਂ ਹੁੰਦਾ ਇੱਕ ਛੁੱਟੀ ਹੁੰਦੀ ਸਰ ਸ਼ਨੀਵਾਰ ਐਤਵਾਰ ਦੀ ਜੀ ਉਹਦੇ ਕਾਰਨ ਘਰ ਦੇ ਨਿੱਜੀ ਕੰਮ ਕਾਰਨ ਕਰਨੇ ਪੈਂਦੇ ਆ ਜਿਹਦੇ ਕਾਰਨ ਜ਼ਿਆਦਾ ਤੌਰ 'ਤੇ ਸਾਨੂੰ ਗੁਰੂ ਘਰ ਦੇ ਨਾਲ ਹੀ ਸਰ ਜ਼ਿਆਦਾ ਲਗਾਓ ਹੈ ਕਿਉਂਕਿ ਰਹਿੰਦੇ ਸਮੇਂ ਤੱਕ ਜੋ ਵੀ ਜਿਸ ਕਿਸੇ ਨੇ ਸਾਥ ਦੇਣਾ ਉਹ ਗੁਰੂ ਘਰ ਜਾਂ ਬਾਣੀ ਪੜ੍ਹਨ ਨਾਲ ਜਾਂ ਕਿ ਨਿਤਨੇਮ ਨੇ ਹੀ ਸਰ ਆਪਾਂ ਨੂੰ ਪਾਰ ਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ